ਹਾਂਜੀ ਸਾਲਾਨਾ ਯਾਤਰਾ ਮੇਲਾ ਵਿੱਚ ਮੈਨੂੰ ਜ਼ਿਆਦਾਤਰ ਚਿੰਤਪੁਰਨੀ ਮਾਤਾ ਦੇ ਨਵਰਾਤਰੀਆਂ ਬਹੁਤ ਵਧੀਆ ਅਸੀਂ ਹਰ ਸਾਲ ਉਹਦੇ ਵਿੱਚ ਜਾਂਦੇ ਹਾਂ ਉਹ ਅਗਸਤ ਦੇ ਲਾਸਟ ਜਾਂ ਅਕਤੂਬਰ ਦੇ ਸਟਾਰਟਿੰਗ ਦੇ ਵਿੱਚ ਹੁੰਦੇ ਛੋਟੇ ਹੁੰਦੇ ਬਚਪਨ ਤੋਂ ਹੀ ਬੜਾ ਹੁੰਦਾ ਸੀ ਵੀ ਸਾਡੇ ਨਾਨਕਿਆਂ ਦਾ ਇੱਕ ਝੰਡਾ ਚੜ੍ਹਦਾ ਹੁੰਦਾ ਚਿੰਤਪੁਰਨੀ ਮਾਤਾ ਦੇ ਤਾਂ ਮੇਰੇ ਮਾਮਾ ਮਾਮੀ ਜੀ ਸਾਰੇ ਬੜੇ ਮਾਮੇ ਛੋਟੇ ਮਾਮੇ ਸਾਰੇ ਇਕੱਠੇ ਹੋ ਕੇ ਹੋਰ ਪਿੰਡ ਦੇ ਸਾਰੇ ਇਕੱਠੇ ਹੋ ਕੇ ਜਾਂਦੇ ਨੇ ਅਤੇ ਉੱਥੇ ਪੈਦਲ ਯਾਤਰਾ ਕਰਦੇ ਹੁੰਦੇ ਸੀ ਅਸੀਂ ਇੱਕ ਦੋ ਦਿਨ ਦੇ ਵਿੱਚ ਪਹੁੰਚ ਜਾਈਦਾ ਹੁੰਦਾ ਸੀ ਪੈਦਲ ਚੱਲ ਚੱਲ ਕੇ ਅਤੇ ਰਾਤ ਅਸੀਂ ਧਰਮਸ਼ਾਲਾ ਵਿੱਚ ਰਹੀਦਾ ਸੀ ਰਾਤ ਨੂੰ ਮਾਤਾ ਰਾਣੀ ਦੀਆਂ ਜੋਤਾਂ ਜਾਂਦੀਆਂ ਵੀ ਅਸੀਂ ਦਰਸ਼ਨ ਕਰਦੇ ਹੁੰਦੇ ਸੀ ਕਈਆਂ ਲੋਕਾਂ ਨੂੰ ਦਿਖ ਜਾਂਦੀਆਂ ਸੀ ਕਈਆਂ ਨੂੰ ਨਹੀਂ ਸੀ ਦਿਖਦੀਆਂ ਤਾਂ ਬੜਾ ਬਹੁਤ ਵਧੀਆ ਲੱਗਦਾ ਹੁੰਦਾ ਸੀ ਵੀ ਸਾਰੇ ਪਾਸੇ ਮਾਤਾ ਦੇ ਭਜਨ ਆਰ ਆਰਤੀ ਹੋਣੀ ਹੈ ਨਾ ਫਿਰ ਸਵੇਰੇ ਮੰਦਰ ਮੱਥਾ ਟੇਕਣਾ ਇੱਦਾਂ ਹੀ ਇੱਕ ਵਾਰ ਸਾਡੇ ਨਾਲ ਕੋਈ ਸਾਡੇ ਪਿੰਡ ਦਾ ਮੇਰੇ ਨਾਨਕੇ ਪਿੰਡ ਦਾ ਕੋਈ ਹੋਰ ਵੀ ਰਿਸ਼ਤੇਦਾਰ ਆਇਆ ਸੀ ਉਹ ਵੀ ਨਾਲ ਚਲਾ ਗਿਆ ਉੱਥੋਂ ਚਿੰਤਪੁਰਨੀ ਮਾਤਾ ਤੋਂ ਜਦ ਅਸੀਂ ਵਾਪਸ ਆ ਰਹੇ ਸੀ ਤਾਂ ਸਾਨੂੰ ਹੁਣ ਕਿਹਾ ਵੀ ਅਸੀਂ ਨਹੀਂ ਬਾਬਾ ਬਾਲਕ ਨਾਥ ਦੇ ਜਾਣਾ ਸਭ ਤੋਂ ਜ਼ਿਆਦਾ ਜ ਜ਼ੋਰ ਵੀ ਉਸ ਮੁੰਡੇ ਨੇ ਪਾਇਆ ਸੀ ਵੀ ਨਹੀਂ ਨਹੀਂ ਉੱਥੇ ਜਾਣਾ ਚਲੋ ਹੌਲੀ ਹੌਲੀ ਸਾਰੀ ਸੰਗਤ ਵੀ ਮੰਨ ਗਈ ਵੀ ਚਲੋ ਆਪਾਂ ਦਰਸ਼ਨ ਕਰ ਆਉਂਦੇ ਹਾਂ ਅਤੇ ਜਦੋਂ ਉਹ ਰਸਤੇ ਦੇ ਵਿੱਚ ਗਿਆ ਉਹਨੂੰ ਦੰਦਲ ਪੈ ਗਈ ਉੱਥੇ ਉਹਦੀ ਡੈਥ ਹੋ ਗਈ ਉਹ ਚੀਜ਼ ਮੈਨੂੰ ਬਹੁਤ ਡਰ ਲੱਗਾ ਸੀ ਵੀ ਮੌਤ ਕਿਹਦੀ ਕਿੱਥੇ ਆਉਣੀ ਆ ਉਸ ਚੀਜ਼ ਦਾ ਕੁਛ ਪਤਾ ਹੀ ਨਹੀਂ ਲੱਗਦਾ ਹੈਗਾ ਔਰ ਮਹਾਰਾਣੀ ਨੇ ਬੁਲਾਇਆ ਪਰ ਉਹ ਬਾਬਾ ਬਾਲਕ ਦਾ ਦੇ ਨਹੀਂ ਸੀ ਜਾ ਸਕਦਾ ਨਹੀਂ ਗਿਆ ਪਰ ਉਸ ਤੋਂ ਬਾਅਦ ਇੱਕ ਸਾਲ ਕੁ ਥੋੜ੍ਹਾ ਮਨ ਨੂੰ ਹੋਇਆ ਵੀ ਨਹੀਂ ਇੱਦਾਂ ਨਹੀਂ ਇੱਦਾਂ ਪਰ ਹੁਣ ਤੱਕ ਵੀ ਅਸੀਂ ਮਾਤਾ ਰਾਣੀ ਦੇ ਹਰ ਸਾਲ ਜਾਂਦੇ ਹਾਂ ਬਹੁਤ ਵਧੀਆ ਲੱਗਦਾ ਆ ਦਰਸ਼ਨ ਕਰਕੇ ਸਾਰੇ ਪਾਸੇ ਮਾਤਾ ਦੇ ਜੈਕਾਰੇ ਲੱਗਦੇ ਨੇ ਲੋਕ ਸ਼ਰਧਾ ਕਰਦੇ ਕੋਈ ਡੰਡੋਤ ਬੰਦਨਾ ਨਾਲ ਮੱਥਾ ਟੇਕਦਾ ਕੋਈ ਪੈਦਲ ਯਾਤਰਾ ਜਾਂਦਾ ਜਿਵੇਂ ਜਿਸ ਦਾ ਸਰਦਾ ਸਾਰੇ ਜਾਂਦੇ ਨੇ ਬਹੁਤ ਵਧੀਆ ਦੇਖਣ ਨੂੰ ਮਿਲਦਾ ਤਾਂ ਜ਼ਰੂਰ ਦੇਖਣਾ ਚਾਹੀਦਾ ਹਰ ਇੱਕ ਇਨਸਾਨ ਨੂੰ ਮਾਤਾ ਦੇ ਨਵਰਾਤਰੇ